ਅੱਜ ਕੱਲ੍ਹ ਦੇ ਸਮੇਂ ਵਿੱਚ ਟੈਕਨੋਲੋਜੀ ਦੇ ਵਧਣ ਦੇ ਨਾਲ ਬਹੁਤ ਸਾਰੀ ਫਸਿਲਿਟੀਈਆਂ ਲੋਕਾਂ ਨੂੰ ਮਿਲਦੀਆਂ ਹਨ ਜਿਵੇਂ ਕਿ ਕਰੈਡਿਟ ਕਾਰਡ ਪੈਨਸ਼ਨ ਪਲੈਨ ਬਹੁਤ ਅਜਿਹੇ ਚੀਜ਼ਾਂ ਹਨ ਜੋ ਸਾਨੂੰ ਫਸਿਲਿਟੀਈਆਂ ਦਿੰਦੇ ਹਨ ਕਰੈਡਿਟ ਕਾਰਡ ਦੇ ਪ੍ਰਯੋਗ ਨਾਲ ਅੱਜ ਬਲੈਕ ਮਨੀ ਵੀ ਖਤਮ ਹੋ ਗਈ ਹੈ ਕਿ ਸਾਨੂੰ ਅਗਰ ਸਾਨੂੰ ਪੈਸੇ ਕਢਾਉਣੇ ਹੋਣ ਤਾਂ ਸਾਨੂੰ ਬੈਂਕ ਨਹੀਂ ਜਾਣਾ ਪੈਂਦਾ ਸਾਨੂੰ ਕਰੈਡਿਟ ਕਾਰਡ ਦੇ ਉਪਯੋਗ ਦੇ ਨਾਲ ਅਸੀਂ ਘਰ ਬੈਠੇ ਹੀ ਕਿਸੇ ਨੂੰ ਵੀ ਪੇਮੈਂਟ ਕਰ ਦਿੰਦੇ ਹਾਂ ਇੱਕ ਥਾਂ ਤੋਂ ਦੂਜੀ ਥਾਂ ਪੈਸੇ ਪਹੁੰਚਾ ਦਿੰਦੇ ਹਾਂ ਅਤੇ ਪੈਨਸ਼ਨ ਪਲੈਨ ਜਿਵੇਂ ਕਿ ਇੰਸੋਰੈਂਸ ਬਹੁਤ ਜ਼ਿਆਦਾ ਇਮਪੋਟੈਂਟ ਹੈ ਕਿਸੇ ਵੀ ਕਿਸੇ ਦੇ ਲਈ ਵੀ ਜਿਵੇਂ ਕਿ ਅਸੀਂ ਪੈਨਸ਼ਨ ਪਲੈਨ ਲੈਂਦੇ ਹਾਂ ਤਾਂ ਅੱਜ ਦੇ ਸਮੇਂ ਵਿੱਚ ਅਸੀਂ ਜਦੋਂ ਪੈਨਸ਼ਨ ਪਲੈਨ ਲਿਤਾ ਅਤੇ ਅਸੀਂ ਉਹਨੂੰ ਅੱਗੇ ਬਹੁਤ ਜ਼ਿਆਦਾ ਸਹਾਇਕ ਇਹ ਰਹੇਗਾ ਕਿਓਂਕਿ ਜਦੋਂ ਅਸੀਂ ਬਜ਼ੁਰਗ ਹੋ ਜਾਵਾਂਗੇ ਤਾਂ ਇਹ ਪੈਨਸ਼ਨ ਪਲੈਨ ਸਾਡੇ ਬਹੁਤ ਕੰਮ ਆਵੇਗਾ ਅਤੇ ਇਹ ਟੈਕਨੋਲੋਜੀ ਦੇ ਕਾਰਨ ਅੱਜ ਅਸੀਂ ਬਹੁਤ ਵਧੀਆ ਤਰੀਕੇ ਨਾਲ ਗ੍ਰੋਅ ਕਰਦੇ ਪਏ ਹਾਂ ਅਤੇ ਸਾਡਾ ਭਾਰਤ ਵੀ ਬਹੁਤ ਗ੍ਰੋਅ ਕਰਦਾ ਪਿਆ ਹੈ